ਪੰਜਾਬ ਵਿੱਚ ਫੁਲਕਾਰੀ ਸ਼ਗਨਾਂ ਦਾ ਪ੍ਰਤੀਕ ਮੰਨੀ ਜਾਂਦੀ ਹੈ ਜੋ ਫੁਲਕਾਰੀ ਕਢਾਈ ਹੈ ਉਹ ਚੁੰਨੀਆ ਦੁਪੱਟਿਆਂ 'ਤੇ ਕੀਤੀ ਜਾਂਦੀ ਹੈ ਅਤੇ ਕੁੜੀਆਂ ਆਪਣੇ ਹੱਥਾਂ ਨਾਲ ਸੂਈ ਧਾਗੇ ਨਾਲ ਕੱਪੜੇ 'ਤੇ ਫੁਲਕਾਰੀ ਦੀ ਕਢਾਈ ਕੱਢਦੀਆਂ ਹਨ ਫੁਲਕਾਰੀ ਦੀਆਂ ਕਈ ਕਿਸਮਾਂ ਹਨ ਇੱਥੇ ਇਸ ਨੂੰ ਵਿਆਹ ਦੇ ਰੀਤੀ ਰਿਵਾਜ਼ਾਂ ਸਮੇਂ ਇਸ ਨੂੰ ਵਰਤਿਆ ਜਾਂਦਾ ਹੈ ਕੁੜੀਆਂ ਨੂੰ ਇਹ ਫੁਲਕਾਰੀ ਦਿੱਤੀ ਜਾਂਦੀ ਹੈ ਜੋ ਲਾਗੀ ਹਨ ਉਹਨਾਂ ਨੂੰ ਫੁਲਕਾਰੀ ਦਿੱਤੀ ਜਾਂਦੀ ਹੈ ਅਤੇ ਜੋ ਰਿਸ਼ਤੇਦਾਰ ਜੋ ਤੀਵੀਆਂ ਹਨ ਨਵੀਂ ਵਿਆਹੀ ਕੁੜੀ ਹੈ ਉਸ ਨੂੰ ਫੁਲਕਾਰੀ ਦਿੱਤੀ ਜਾਂਦੀ ਹੈ ਜੋ ਫੁਲਕਾਰੀ ਹੈ ਉਸਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਬਾਗ ਆ ਚੋਪ ਅਤੇ ਸੁਬਰ ਆ ਨੀਲਕਾ ਤਿਲ ਪੱਤਰਾ ਅਤੇ ਸ਼ਮਾਸ਼ ਆ ਜੋ ਬਾਗ ਹੈ ਉਹ ਬਹੁਤ ਸੰਘਣੀ ਤਰ੍ਹਾਂ ਦੀ ਕਢਾਈ ਕੀਤੀ ਜਾਂਦੀ ਹੈ ਇਹ ਖੱਦਰ ਦੇ ਕੱਪੜੇ 'ਤੇ ਤਿਰਕੋਣੇ ਢੰਗ ਨਾਲ ਕਢਾਈ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਰੰਗ ਬਿਰੰਗੇ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪੀਲਾ ਅਤੇ ਲਾਲ ਰੰਗ ਇਸ ਨੂੰ ਉਸ ਸਮੇਂ ਵਰਤਿਆਂ ਜਾਂਦਾ ਹੈ ਅਤੇ ਚੋਪ ਅਤੇ ਸੁਬਰ ਜੇ ਇਹ ਇੱਕ ਖੱਦਰ ਉੱਤੇ ਜਿਹੜਾ ਗੂੜਾ ਲਾਲ ਖੱਦਰ ਆ ਉਹਦੇ 'ਤੇ ਇਹ ਕਢਾਈ ਕੱਢੀ ਜਾਂਦੀ ਹੈ ਅਤੇ ਜਿਹੜਾ ਨੀਲਕ ਹੈ ਨੀਲਕੇ ਰੇਸ਼ਮ ਦੇ ਧਾਗੇ ਨਾਲ ਕੱਢੀ ਜਾਂਦੀ ਕਢਾਈ ਹੈ ਅਤੇ ਇਹ ਨੀਲੇ ਜਾਂ ਕਾਲੇ ਰੰਗ ਦੇ ਕੱਪੜੇ 'ਤੇ ਕੱਢੀ ਜਾਂਦੀ ਹੈ ਜੋ ਸਮਾਸ ਆ ਇਹ ਹਰਿਆਣੇ ਦੇ ਖੇਤਰ ਵਿੱਚ ਜੋ ਫੁਲਕਾਰੀ ਪ੍ਰਚਲਿੱਤ ਹੈ ਉਸ ਨੂੰ ਕਿਹਾ ਜਾਂਦਾ ਹੈ ਤਿਲ ਪੱਤਰਾਂ ਇਹ ਜੋ ਪਹਿਲਾਂ ਲਾਗੀ ਹੁੰਦੇ ਸਨ ਵਿਆਹ ਸਮੇਂ ਇਹ ਉਹਨਾਂ ਨੂੰ ਫੁਲਕਾਰੀ ਦਿੱਤੀ ਜਾਂਦੀ ਸੀ ਅਤੇ ਇਸ 'ਤੇ ਕਿਤੇ ਕਿਤੇ ਟਾਂਕੇ ਪਾਏ ਜਾਂਦੇ ਸਨ ਮਤਲਬ ਕਿ ਜੋ ਇਹਦੇ 'ਤੇ ਫੁੱਲ ਕੱਢੇ ਜਾਂਦੇ ਸਨ ਜਾਂ ਤਿਰਕੋਣੇ ਜਾਂ ਚੋਰਸ ਹੁੰਦੇ ਆ ਉਹ ਮਤਲਬ ਕਿਤੇ ਕਿਤੇ ਕੱਢੇ ਜਾਂਦੇ ਸਨ ਵਿੱਚ ਵਿੱਚ ਮਤਲਬ ਗੈਪ ਪਾਇਆ ਜਾਂਦਾ ਸੀਗਾ ਉਸ ਨੂੰ ਕਿਹਾ ਜਾਂਦਾ ਹੈ ਤਿਲ ਪੱਤਰਾ ਪਰ ਮੈਨੂੰ ਸਭ ਤੋਂ ਜ਼ਿਆਦਾ ਬਾਗ ਵਧੀਆ ਲੱਗਦਾ ਕਿਉਂਕਿ ਇਸ ਦੀ ਕਢਾਈ ਬਹੁਤ ਸੰਘਣੀ ਹੁੰਦੀ ਆ ਇਹ ਬਹੁਤ ਭਾਰਾ ਹੁੰਦਾ ਅਤੇ ਵਿਆਹ ਸਮੇਂ ਮਤਲਬ ਬਹੁਤ ਜ਼ਿਆਦਾ ਸੋਹਣਾ ਲੱਗਦਾ ਕੁ ਮਤਲਬ ਵਿਆਹ ਸਮੇਂ ਚਾਰ ਚੰਦ ਲੱਗ ਜਾਂਦੇ ਹਨ ਜਦੋਂ ਕੋਈ ਵੀ ਰੀਤੀ ਰਿਵਾਜ਼ ਹੁੰਦਾ ਜਿਵੇਂ ਕਿ ਆਪਣੇ ਵਟਨਾ ਮਲਦੇ ਆ ਹੈ ਨਾ ਹਲਦੀ ਦੀ ਰਸਮ ਹੁੰਦੀ ਹੈ ਉਦੋਂ ਵੀ ਇਸ ਨੂੰ ਮਤਲਬ ਚਾਦਰ ਦੀ ਤਰ੍ਹਾਂ ਤਾਣਿਆ ਜਾਂਦਾ ਹੈ ਅਤੇ ਇਸ ਨੂੰ ਸ਼ੁੱਭ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਮੈਨੂੰ ਬਾਗ ਬਹੁਤ ਵਧੀਆ ਲੱਗਦਾ